ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਜੀ ਠੀਕ ਅੱਛਾ ਜੀ ਬੋਲੋ ਜੀ ਹਾਂਜੀ ਆਨੰਦ ਸਕੂਲ ਤੋਂ ਮੈਂ ਪ੍ਰਿੰਸੀਪਲ ਬੋਲ ਰਿਹਾ ਦੱਸੋ ਹਾਂਜੀ ਅਨੀਕੇਤ ਬੋਲੋ ਹਾਂ ਮੈਨੂੰ ਤੁਹਾਡਾ ਰਜਿਸਟਰ ਵੀ ਆਇਆ ਸੀਗਾ ਜਿਹਦੇ ਵਿੱਚ ਤੁਹਾਡੀ ਅਪਸੈਟ ਆ ਰਹੀ ਸੀਗੀ ਕੀ ਈਸ਼ੂ ਆ ਰਿਹਾ ਓਕੇ ਅੱਛਾ ਜੀ ਕਿੰਨੇ ਦਿਨ ਦੀ ਬੈੱਡ ਰੈਸਟ ਕਹੀ ਆ ਤੁਹਾਨੂੰ ਉਹਨਾਂ ਨੇ ਅੱਛਾ ਜੀ ਓਕੇ ਅਤੇ ਬੇਟਾ ਫੇਰ ਇੱਦਾਂ ਵਾ ਤੁਹਾਡਾ ਇਹਦੇ ਪਿੱਛੇ ਪੜ੍ਹਾਈ ਦਾ ਨੁਕਸਾਨ ਜਿਹੜਾ ਹੋਏਗਾ ਅਸੀਂ ਇਹ ਚੀਜ਼ ਕਰ ਸਕਦੇ ਹਾਂ ਤੁਹਾਡੇ ਲਈ ਕੀ ਤੁਸੀਂ ਘਰ ਔਨਲਾਈਨ ਕਲਾਸਾਂ ਅਟੈਂਡ ਕਰ ਸਕਦੇ ਹੋ ਹਾਂ ਹਾਂ ਅਤੇ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਜਾਂ ਤਾਂ ਤੁਹਾਨੂੰ ਇਹਦੇ ਨਾਲ ਜਿਹੜੇ ਲੈਕਚਰ ਜਿਹੜੇ ਸਾਰੀ ਦਿਹਾੜੀ ਸਾਡੇ ਲਗਦੇ ਆ ਦਿਨ ਦੇ ਉਹ ਮੈਂ ਟੀਚਰ ਨੂੰ ਤੁਹਾਡੇ ਜਿਹੜੇ ਹੈਗੇ ਆ ਉਹਨਾਂ ਨੂੰ ਕਹਿ ਦਿਆਂਗਾ ਕਿ ਉਹ ਤੁਹਾਨੂੰ ਜਿਹੜਾ ਹੈਗਾ ਵਾ ਲੈਕਚਰ ਦਾ ਜਿਹੜੇ ਹੈਗੀ ਹੈ ਜਾਂ ਤਾਂ ਕੋਪੀ ਜਿਹੜੀ ਹੈਗੀ ਹੈ ਪੀ ਡੀ ਐਫ ਬਣਾ ਕੇ ਉਹ ਭੇਜ ਦੇਣ ਜਾਂ ਕੋਈ ਵੀਡੀਓ ਟਟੋਰੀਅਲ ਜਿਹੜਾ ਹੈਗਾ ਵਾ ਤੁਹਾਨੂੰ ਪ੍ਰੋਵਾਈਡ ਕਰ ਦੇਣ ਜਦ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ ਤੁਸੀਂ ਉਹਦੇ ਨਾਲ ਜਿਹੜੀ ਹੈਗੀ ਆ ਆਪਣੀ ਜਿਹੜੀ ਹੈਗੀ ਆ ਸਟੱਡੀ ਕੰਪਲੀਟ ਕਰਦੇ ਰਹਿਣਾ ਜੇੇੇ ਤੁਹਾਨੂੰ ਜੇ ਤਾਂ ਵੀ ਤੁਹਾਡੀ ਤਬੀਅਤ ਠੀਕ ਹੁੰਦੀ ਹੈ ਥੋੜ੍ਹੀ ਜੀ ਹੁੰਦੀ ਹੈ ਤੁਸੀਂ ਆਪਣੇ ਜਿਹੜਾ ਹੈਗਾ ਵਾ ਉਹ ਲੈਕਚਰ ਜਿਹੜੇ ਹੈਗੇ ਹੈ ਸੁਣ ਕੇ ਜਾਂ ਪੜ੍ਹ ਕੇ ਆਪਣੀ ਜਿਹੜੀ ਹੈਗੀ ਤੁਹਾਡੀ ਤਾਂ ਕਿ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਬਾਕੀ ਬਾਕੀ ਤੁਸੀਂ ਜਿਹੜਾ ਹੈਗਾ ਉਹ ਤੁਹਾਡੀ ਜੋ ਵੀ ਮੈਡੀਕਲ ਰਿਪੋਰਟ ਹੈਗੀ ਆ ਆਪਣੇ ਕਿਸੇ ਰੈਲਟਿਵ ਯਾਂ ਆਪਣੇ ਫੈਮਲੀ ਮੈਂਬਰ ਦੇ ਹੱਥ ਜਿਹੜੀ ਹੈਗੀ ਆ ਤੁਹਾਡੇ ਕੋਲ ਉਹ ਕੋਲੇਜ ਦੇ ਸਕੂਲ ਦੇ ਵਿੱਚ ਪਹੁੰਚਦੀ ਕਰਵਾ ਦਿਓ ਤਾਂ ਕਿ ਅਸੀਂ ਉਹਨੂੰ ਤੁਹਾਡੇ ਜਿਹੜੇ ਹੈਗੇ ਰਕੋਡ ਦੇ ਵਿੱਚ ਲਗਾ ਲਈਏ ਠੀਕ ਹੈ ਜੀ ਬਾਕੀ ਤੁਸੀਂ ਅਸੀਂ ਉਮੀਦ ਕਰਦੇ ਤੁਸੀਂ ਛੇਤੀ ਤੋਂ ਛੇਤੀ ਰਿਕਵਰ ਹੋ ਕੇ ਸਾਡੇ ਸਕੂਲ ਦੇ ਵਿੱਚ ਵਾਪਸ ਜੁਆਇਨ ਕਰੋ ਅਤੇ ਤੁਸੀਂ ਬੇਫ਼ਿਕਰ ਹੋ ਕੇ ਆਪਣਾ ਧਿਆਨ ਰੱਖੋ ਅਤੇ ਆਪਣੇ ਜਿਹੜੇ ਹੈਗੀ ਹੈ ਉਸ ਤੋਂ ਬਾਅਦ ਠੀਕ ਹੋਣ ਤੋਂ ਬਾਅਦ ਸਕੂਲ ਨੂੰ ਵਾਪਸ ਜੁਆਇਨ ਕਰ ਲਓ ਓਕੇ ਓਕੇ ਜੀ ਹਾਂਜੀ

ਹਾਂ ਠੀਕ ਹੈ ਜੀ ਉਹ ਹੋ ਜਾਏਗਾ ਓਕੇ ਬੇਟਾ ਟੇਕ ਕੇਅਰ